ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੈਫੇ ਇਟਾਲੀਆ ਤੋਂ ਬੋਲ ਰਹੇ ਹੋ ਮੈਂ ਸਨਮੀਤ ਸਿੰਘ ਬੋਲ ਰਿਹਾ ਹਾਂ ਖਾਲਸਾਪੁਰ ਰੋਡ ਤਰਨ ਤਾਰਨ ਤੋਂ ਅੱਜ ਮੇਰੇ ਕੁਛ ਦੋਸਤਾਂ ਨੇ ਕੈਨੇਡਾ ਤੋਂ ਘਰ ਆਉਣਾ ਸੀਗਾ ਇਸ ਲਈ ਮੈਂ ਕੁਛ ਔਡਰ ਕਰਨਾ ਸੀਗਾ ਮੈਂ ਤੁਹਾਡੇ ਰੈਸਟੋਰੈਂਟ 'ਤੇ ਪਹਿਲੇ ਵੀ ਕਾਫੀ ਵਾਰ ਆ ਚੁੱਕਾ ਹੋਇਆ ਵਾ ਤੁਹਾਡੀਆਂ ਡਿਸ਼ਿਸ ਕਾਫੀ ਸਹੀ ਰਹਿੰਦੀਆਂ ਨੇ ਇਸ ਲਈ ਮੈਂ ਕੁਛ ਔਡਰ ਕਰਨਾ ਚਾਹੁੰਦਾ ਹਾਂ ਤੁਹਾਡਾ ਮੈਨਿਊ ਮੈਂ ਦੇਖਿਆ ਕਾਫੀ ਪੀਜ਼ਾ ਵਗੈਰਾ ਐਂਡ ਹੋਰ ਕਾਫੀ ਚੀਜ਼ਾਂ ਮੈਂ ਔਡਰ ਪਹਿਲੇ ਵੀ ਕ ਕਰ ਚੁੱਕਾ ਹਾਂ ਇਸ ਲਈ ਮੈਨੂੰ ਸ਼ਾਮ ਅੱਠ ਵਜੇ ਤੱਕ ਮੈਂ ਆਉਂਗਾ ਅਤੇ ਦੋ ਪੀਜ਼ਾਜ ਲਾਰਜ ਸਾਈਜ਼ ਦੇ ਐਂਡ ਕੁਛ ਬਰਵਰੇਜ ਵਗੈਰਾ ਤੁਸੀਂ ਔਡਰ ਟਾਈਮ ਸਿਰ ਔਡਰ ਕਰ ਦਿਉ ਅਤੇ ਡਿਲੀਵਰੀ ਮੈਨ ਨੂੰ ਟਿਪ ਵਗੈਰਾ ਵੀ ਅੱਛੀ ਦੇਵਾਂਗੇ ਜਿਹੜਾ ਵੀ ਡਿਲੀਵਰੀ ਵਾਲਾ ਆਏਗਾ ਅਤੇ ਤੁਹਾਡਾ ਟੇਸਟ ਵਗੈਰਾ ਸਹੀ ਹੋਣਾ ਚਾਹੀਦਾ ਸ ਅਸੀਂ ਪਹਿਲੇ ਵੀ ਕਾਫੀ ਵਾਰੀ ਔਡਰ ਕਰ ਚੁੱਕੇ ਹੋਏ ਹਾਂ ਅਤੇ ਇਸ ਲਈ ਇਸ ਵਾਰੀ ਸਾਨੂੰ ਕੁਆਲਿਟੀ ਵਗੈਰਾ ਮੈਂਟੇਨ ਕਰਕੇ ਰੱਖਿਉ ਉਸ ਤਰ੍ਹਾਂ ਹੀ ਤਾਂ ਕਿ ਕਿਉਂਕਿ ਸਾਡੇ ਬਾਹਰੋਂ ਗੈਸਟ ਵਗੈਰਾ ਆ ਰਹੇ ਨੇ ਤਾਂ ਕਿ ਉਹ ਖੁਸ਼ ਰਹਿਣ ਅਤੇ ਵਧੀਆ ਉਹਨਾਂ ਨੂੰ ਕੁਆਲਿਟੀ ਸਹੀ ਲੱਗੇ ਓਕੇ